ਮੈਂ ਦੋ ਤਿੰਨ ਘੰਟੇ ਫੇਸਬੁਕ ਐਪ ਉੱਤੇ ਬਿਤਾਉਂਦਾ ਹਾਂ ਮੈਂ ਇਸ ਉੱਪਰ ਖਬਰਾਂ ਸੁਣਦਾ ਅਤੇ ਸਤਿਸੰਗ ਸੁਣਦਾ ਹਾਂ ਇਹ ਐਪ ਦਿਨ ਬਾਏ ਦਿਨ ਹੋ ਰਹੀਆਂ ਘਟਨਾਵਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ